ਪੰਜਾਬੀ ਭਾਸ਼ਾ ਭਾਰ ਭਾਰਤ ਦੇ ਵੱਖ ਵੱਖ ਹਿੱਸਿਆਂਂ ਵਿੱਚ ਸੱਭਿਆਚਾਰ ਵਟਾਂਦਰੇ ਅਤੇ ਸੰਚਾਰ ਵਿੱਚ ਮਹਤੱਵਪੂਰਨ ਭੂਮਿਕਾ ਨਿਭਾਉਂਦੀ ਕਿਉਂਕਿ ਜਿਹੜੇ ਪੰਜਾਬ ਦੇ ਲੋਕੀ ਆ ਉਹ ਪੂਰੇ ਇੰਡੀਆ 'ਚ ਫੈਲੇ ਹੋਏ ਨੇ ਅਤੇ ਜਿਹੜੀ ਪੰਜਾਬੀ ਬੋਲੀ ਹੈ ਉਹ ਪੂਰੇ ਸਾਡੇ ਪੰਜਾਬ ਚ ਦੇ ਦੇਸ਼ ਵਿੱਚ ਪਸੰਦ ਕੀਤੀ ਜਾਂਦੀ ਹੈ ਅਤੇ ਇੱਥੋਂ ਦੇ ਲੋਕੀ ਬੜਾ ਮਿੱਠਾ ਬੋਲਦੇ ਨੇ ਅਤੇ ਇਹਨਾਂ ਨੇ ਸਾਡੇ ਦੇਸ ਦੀ ਆਜ਼ਾਦੀ ਵਿੱਚ ਬੜਾ ਮਹੱਤਵਪੂਰਨ ਯੋਗਦਾਨ ਪਾਇਆ ਤੁਸੀਂ ਜਾਣਦੇ ਹੋਣੇ ਸ਼ਹੀਦ ਭਗਤ ਸਿੰਘ ਨੂੰ ਜਿਸ ਨੇ ਦੇਸ ਦੀ ਆਜ਼ਾਦੀ ਲਈ ਘੱਟ ਉਮਰ 'ਚ ਹੀ ਆਪਣੀ ਕੁਰਬਾਨੀ ਦੇ ਦਿੱਤੀ ਸੀ ਬਾਕੀ ਸ਼ਹੀਦ ਊਧਮ ਸੀ ਹੋਰ ਵੀ ਬੜੇ ਵੀਰ ਬਹਾਦਰ ਨੇ ਜਿਨ੍ਹਾਂ ਨੇ ਆਪਣੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਨੇ ਅਤੇ ਵੈਸੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਜਿਹੜਾ ਪੰਜਾਬ ਦਾ ਲੋਕ ਗੀਤ ਹੈ ਉਹ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ ਲੋਕਾਂ ਵੱਲੋਂ ਅਤੇ ਇਸ ਦੇ ਗੀਤਾਂ ਨੂੰ ਬੋਲੀਵੁੱਡ ਵਿੱਚ ਵੀ ਵਿੱਚ ਵੀ ਜਿ ਐਂਟਰੀ ਦਿੱਤੀ ਜਾਂਦੀ ਹੈ ਇਹਨਾਂ ਦੇ ਗੀਤ ਬੋਲੀਵੁੱਡ ਦੀ ਫਿਲਮਾਂ ਵਿੱਚ ਵੀ ਲਏ ਜਾਂਦੇ ਹਨ